ਜ਼ਿੰਦਗੀ ਲਈ ਜੋ ਸਿਹਤ ਹੈ ਉਹ ਬਹੁਤ ਹੀ ਜ਼ਰੂਰੀ ਹੈ ਇਸ ਨੂੰ ਸੰਭਾਲ ਕਰਨੀ ਚਾਹੀਦੀ ਹੈ ਵਧੀਆ ਖਾਣਾ ਖਾਣਾ ਚਾਹੀਦਾ ਹੈ ਜੋ ਕਿ ਅੱਜ ਦੇ ਟਾਈਮ ਵਿੱਚ ਨਹੀਂ ਹੁੰਦਾ ਅੱਜ ਕੱਲ੍ਹ ਬਹੁਤ ਹੀ ਨਵੀਆਂ ਨਵੀਆਂ ਚੀਜ਼ਾਂ ਆ ਗਈਆਂ ਹਨ ਪੀਜ਼ਾ ਬਰਗਰ ਲੋਕ ਰੋਟੀ ਦਾਲ ਨੂੰ ਭੁੱਲ ਚੁੱਕੇ ਹਨ ਕਸਬੇ ਦੇ ਮੁਕਾਬਲੇ ਕਸਬੇ ਦੇ ਵਿੱਚ ਗੰਦਗੀ ਵੀ ਹੈ ਮਿੱਟੀ ਵੀ ਹੈ ਧੂੜ ਵੀ ਉੱਡਦੀ ਹੈ ਜਿਹੜਾ ਪਲਾਸਟਿਕ ਹੈ ਜੋ ਅੱਜ ਦਾ ਮੇਨ ਜਿਹੜਾ ਸਭ ਤੋਂ ਖਤਰਨਾਕ ਕਹਿ ਸਕਦੇ ਹਾਂ ਜੋ ਕਿ ਜਲਦੀ ਗੱਲਦਾ ਨਹੀਂ ਖਤਮ ਨਹੀਂ ਹੁੰਦਾ ਮੁੱਕਦਾ ਨਹੀਂ ਇਹ ਸਭ ਨੂੰ ਜ਼ਿਆਦਾ ਬਿਮਾਰ ਕਰਦਾ ਹੈ ਵਾਤਾਵਰਨ ਦਾ ਇੱਕ ਵਾਤਾਵਰਨ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਇਹ ਬਹੁਤ ਜ਼ਿਆਦਾ ਗੰਦਲਾ ਹੋ ਰਿਹਾ ਹੈ ਗੱਡੀਆਂ ਬਹੁਤ ਵੱਧ ਗਈਆਂ ਹਨ ਧੂੰਆਂ ਬਹੁਤ ਜ਼ਿਆਦਾ ਹੋ ਗਿਆ ਹੈ ਜਿਸ ਕਰਕੇ ਸਿਹਤ ਜਿਹੜੀ ਹੈ ਉਹ ਲੋਕਾਂ ਦੀ ਖਰਾਬ ਚੱਲ ਰਹੀ ਹੈ ਪੇੜ ਕੱਟੀ ਜਾ ਰਹੇ ਹਾਂ ਆਬਾਦੀ ਵੱਧਦੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੋ ਸਕਦੀ ਹੈ ਆਉਣ ਵਾਸਤੇ ਆਉਣ ਦੇ ਟਾਈਮ ਲਈ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਸਾਫ ਸਫਾਈ ਹੋਵੇ ਪੂਰੀ ਫਿਰ ਥੋੜ੍ਹੀ ਸਿਹਤ ਨੂੰ ਜਿਹੜੀ ਸ਼ਹਿਰਾਂ ਵਿੱਚ ਹੈ ਉੱਥੇ ਵੀ ਇਹੋ ਹੀ ਹਾਲ ਨੇ